ਮੈਂ ਇੱਕ ਵਾਰ ਆਪਣੀ ਫੈਮਲੀ ਨਾਲ ਸ਼ਿਮਲੇ ਦੀ ਯਾਤਰਾ ਕਰਨ ਗਈ ਸੀ ਅਸੀਂ ਸਾਰੇ ਫੈਮਿਲੀ ਮੈਂਬਰ ਉੱਥੇ ਗਏ ਸਨ ਅਸੀਂ ਉੱਥੇ ਇੱਕ ਹਫਤਾ ਰੁਕੇ ਸੀ ਅਤੇ ਅਸੀਂ ਬਹੁਤ ਸਾਰੀਆਂ ਜਗ੍ਹਾਵਾਂ ਦੇਖੀਆਂ ਸ਼ਿਮਲੇ ਵਿੱਚ ਅਤੇ ਉੱਥੇ ਦਾ ਬਜ਼ਾਰ ਬਹੁਤ ਵਧੀਆ ਸੀ ਅਸੀਂ ਉੱਥੇ ਬਹੁਤ ਸਾਰੀਆਂ ਚੀਜ਼ਾਂ ਖਰੀਦੀਆਂ ਅਤੇ ਉੱਥੇ ਦਾ ਨਜ਼ਾਰਾ ਹੀ ਬਹੁਤ ਵਧੀਆ ਸੀ ਬਹੁਤ ਲੋਕ ਉੱਥੇ ਘੁੰਮਣ ਜਾਂਦੇ ਹਨ ਅਤੇ ਅਤੇ ਅਸੀਂ ਰਾਤ ਨੂੰ ਬਾਹਰ ਭੋਜਨ ਕੀਤਾ ਫਿਰ ਦੂਜੀ ਸਵੇਰ ਅਸੀਂ ਜਦੋਂ ਉੱਠੇ ਤਾਂ ਉੱਠੇ ਤਾਂ ਮੈਂ ਦੇਖਿਆ ਕਿ ਮੇਰੀ ਖਿੜਕੀ ਖਿੜਕੀ 'ਤੇ ਸੂਰਜ ਦਾ ਸੂਰਜ ਦੀਆਂ ਕਿਰਨਾਂ ਆ ਰਹੀਆਂ ਸਨ ਉਦੋਂ ਸੂਰਜ ਉੱਗਦਾ ਸੀ ਅਤੇ ਉਸ ਦੀਆਂ ਕਿਰਨਾਂ ਪਹਾੜੀ ਉੱਤੇ ਪੈਂਦੀਆਂ ਸਨ ਅਤੇ ਉਹ ਨਜ਼ਾਰਾ ਬਹੁਤ ਵਧੀਆ ਸੀ ਅਸੀਂ ਬਹੁਤ ਫੋਟੋਆਂ ਓ ਖਿਚਾਈਆਂ ਉੱਥੇ ਉਹ ਨਜ਼ਾਰਾ ਮੈਨੂੰ ਅੱਜ ਵੀ ਯਾਦ ਹੈ